ਇੱਕ ਨਵੇਂ ਜੰਮੇ ਬੱਚਿਆਂ ਨੂੰ ਇੱਕ ਸਵੱਛ ਵਾਤਾਵਰਨ ਦੇਣ ਵਾਸਤੇ ਅਪ ਅਸੀਂ ਕਾਫੀ ਕੁਝ ਕਰ ਸਕਦੇ ਹਾਂ ਅਤੇ ਸਾਨੂੰ ਕਰਨਾ ਵੀ ਚਾਹੀਦਾ ਕਿਉਂਕਿ ਬੱਚਿਆਂ ਦੀ ਸਕਿ ਬੱਚਿਆਂ ਦੀ ਬੋਡੀ ਕਾਫੀ ਸੈਂਸਿਟਿਵ ਹੁੰਦੀ ਆ ਅਤੇ ਉੱਤੇ ਕਾਫੀ ਸਾਰੇ ਵੱਖਰੇ ਵੱਖਰੇ ਬੈਕਟੀਰੀਆ ਫੋਰਮ ਹੋ ਸਕਦੇ ਹਨ ਜਿਸਦੇ ਨਾਲ ਉਹਨਾਂ ਨੂੰ ਵੱਖਰੇ ਬਿਮਾਰੀਆਂ ਪੈ ਸਕਦੀਆਂ ਹਨ ਪਹਿਲੀ ਚੀਜ਼ ਅਸੀਂ ਕਰਦੇ ਹਾਂ ਉਹ ਬੱਚੇ ਨੂੰ ਫੜਨ ਤੋਂ ਪਹਿਲਾਂ ਜ਼ਰੂਰ ਘੱਟ ਤੋਂ ਘੱਟ ਇੱਕ ਮਿੰਟ ਲਾ ਕੇ ਆਪਣੇ ਹੱਥ ਜ਼ਰੂਰ ਧੋਣੇ ਚਾਹੀਦੇ ਆ ਜਿਹਦੇ ਨਾਲ ਆਪਣੇ ਹੱਥ ਬਿਲਕੁਲ ਸਾਫ਼ ਸੁਥਰੇ ਹੋਣ ਅਤੇ ਕੋਈ ਵੀ ਸਾਡੇ ਕੋਲ ਬੈਕਟੀਰੀਆ ਵਗੈਰਾ ਨਾ ਹੋਵੇ ਜੇ ਜਿਹੜਾ ਅਸੀਂ ਬੱਚਿਆਂ ਨੂੰ ਦੇ ਸਕਦੇ ਹਾਂ ਅਤੇ ਨਾਲ ਕਮਰੇ ਤੱਕ ਘੁਸਨ ਤੋਂ ਪਹਿਲਾਂ ਕੋਈ ਵੀ ਪਰਫਿਊਮ ਵਗੈਰਾ ਲਾ ਜਿਹਦੇ ਵਿੱਚ ਜਿਸ ਕਮਰੇ ਵਿੱਚ ਬੱਚੇ ਨੂੰ ਰੱਖਿਆ ਹੋਇਆ ਹੈ ਉਸ ਕਮਰੇ ਵਿੱਚ ਘੁਸਨ ਤੋਂ ਪਹਿਲਾਂ ਕੋਈ ਵੀ ਪਰਫਿਊਮ ਵਗੈਰਾ ਲ ਲਾਏ ਬਿਨਾਂ ਜਾਣਾ ਵਾ ਕਿਉਂਕਿ ਪਰਫਿਊਮ ਵਿੱਚ ਵੀ ਕਾਫੀ ਸਾਰੇ ਕੈਮੀਕਲ ਹੁੰਦੇ ਹਨ ਜਿਹੜੇ ਬੱਚੇ ਦੇ ਕੋਲ ਆਉਣ ਆ ਕਰਕੇ ਬੱਚੇ ਨੂੰ ਬੱਚੇ ਦੇ ਵਿੱਚ ਕਾਫੀ ਸਾਰੇ ਬੈਕਟੀਰੀਆ ਫੋਮ ਬੱਚੇ ਦੇ ਆਸ ਪਾਸ ਵਾਤਾਵਰਨ 'ਚ ਕਾਫੀ ਸਾਰੇ ਬੈਕਟੀਰੀਆ ਫੋਰਮ ਕਰ ਸਕਦੇ ਹਨ ਜਿਹਦੇ ਨਾਲ ਬੱਚੇ ਨੂੰ ਅੱਗੇ ਪ੍ਰੋਬਲਮ ਹੋ ਸਕਦੀ ਆ ਅਤੇ ਸਭ ਤੋਂ ਜ਼ਿਆਦਾ ਇੱਕ ਟਿਸ਼ੂ ਦਾ ਪੈਕਟ ਜ਼ਰੂਰ ਰੱਖਿਓ ਆਪਣੇ ਕੋਲ ਜਿਹਦੇ ਨਾਲ ਆ ਆਪਣੇ ਹੱਥ ਵਗੈਰਾ ਮੂੰਹ ਹੱਥ ਵਗੈਰਾ ਜਾਂ ਬੱਚੇ ਨੂੰ ਸਾਫ਼ ਕਰਨ ਵਾਸਤੇ ਆਸਾਨੀ ਹੋ ਹੋਵੇ ਅਤੇ ਬੱਚੇ ਦੀ ਜਿਸ ਚੀਜ਼ ਵਿੱਚ ਜਿਹੜੇ ਬੈੱਡ ਜਿਹੜੇ ਬੈੱਡ ਦੇ ਉੱਤੇ ਬੱਚੇ ਨੂੰ ਰੱਖਿਆ ਹੋਇਆ ਉਹ ਬੈਡ ਵੀ ਵਾਰ ਵਾਰ ਜ਼ਰੂਰ ਤੋਂ ਜ਼ਰੂਰ ਬਾਤ ਹਰ ਪੰਦਰਾਂ ਪੰਦਰਾਂ ਮਿੰਟ ਬਾਅਦ ਘੰਟੇ ਘੰਟੇ ਬਾਅਦ ਚੇਂਜ ਹੁੰਦਾ ਰਹੇ ਤਾਂ ਕੀ ਸਾਰਾ ਵਾਤਾਵਰਨ ਸਾਫ਼ ਸੁਥਰਾ ਰਹੇ ਕਮਰੇ ਵਿੱਚ ਵੀ ਦਿਨ ਵਿੱਚ ਘੱਟ ਤੋਂ ਘੱਟ ਦੋ ਵਾਰੀ ਐਟਲਿਸਟ ਪੋਚਾ ਮਾਰਿਆ ਜਾਵੇ ਜਾਂ ਸਫਾਈ ਕੀਤੀ ਜਾਵੇ ਤਾਂ ਕਿ ਵਾਤਾਵਰਨ ਬਿਲਕੁਲ ਸਾਫ਼ ਸੁਥਰਾ ਰਹੇ ਇਹਦੇ ਨਾਲ ਬੱਚੇ ਦੇ ਆਸ ਪਾਸ ਕੋਈ ਬੈਕਟੀਰੀਆ ਫੋਰਮ ਨਹੀਂ ਹੋਊਗਾ ਅਤੇ ਬੱਚਾ ਪੂਰਾ ਤੰਦਰੁਸਤ ਅ ਤੰਦਰੁਸਤ ਰਹੂਗਾ ਅਤੇ ਕੋਈ ਪ੍ਰੋਬਲਮ ਨਹੀਂ ਆਏਗੀ ਥੈਂਕ ਯੂ